ਕਿੱਤੇ ਤਾਂ ਅੰਮ੍ਰਿਤਸਰ ਵਿੱਚ ਬਹੁਤ ਜ਼ਿਆਦਾ ਹੈਗੇ ਆ ਜਿਨ੍ਹਾਂ ਵਿੱਚ ਲੋਕ ਆਪਣਾ ਕਰੀਅਰ ਬਣਾਉਂਦੇ ਆ ਜਿਸ ਤਰ੍ਹਾਂ ਹੁਣ ਅੰਮ੍ਰਿਤਸਰ ਵਿੱਚ ਇੱਕ ਟੂਰਿਸਟ ਏਰੀਆ ਹੈਗਾ ਟੂਰਿਸਟ ਏਰੀਆ ਹੋਣ ਕਰਕੇ ਇਸ ਚੀਜ਼ ਦਾ ਲੋਕ ਇਹ ਫਾਇਦਾ ਉਠਾਉਂਦੇ ਆ ਕਿ ਜਿਸ ਤਰ੍ਹਾਂ ਦਰਬਾਰ ਸਾਹਿਬ ਆ ਜਾਂ ਕੋਈ ਸ਼ਹੀਦਾਂ ਵਾਲਾ ਇਹਦੇ ਆਸ ਪਾਸ ਲੋਕ ਦੁਕਾਨਾਂ ਆਪਣੀਆਂ ਚਲਾ ਰਹੇ ਹੁੰਦੇ ਦੁਕਾਨਾਂ ਖੋਲ੍ਹ ਲੈਂਦੇ ਆ ਜਿਸ ਤਰ੍ਹਾਂ ਦਾ ਲੋਕਾਂ ਦਾ ਟੇਸਟ ਹੁੰਦਾ ਸਮਾਨ ਲਿਆਂਦਾ ਉਸ ਤਰ੍ਹਾਂ ਦੀਆਂ ਚੀਜ਼ਾਂ ਰੱਖਦੇ ਆ ਤਾਂ ਕਿ ਲੋਕ ਆਉਣ ਅਤੇ ਖਰੀਦਣ ਜਾਂ ਫਿਰ ਇਸ ਤਰ੍ਹਾਂ ਹੁੰਦਾ ਕਿ ਖਾਣ ਪੀਣ ਦਾ ਹੋ ਜਾਂਦਾ ਖਾਣ ਪੀਣ ਵਾਲਾ ਸ ਰੱਖਦੇ ਲੋਕ ਉੱਥੇ ਅਤੇ ਲੋਕ ਜਿਨ੍ਹਾਂ ਨੇ ਬਾਹਰੋਂ ਆਉਣਾ ਉਹਨਾਂ ਨੇ ਖਾਣਾ ਪੀਣਾ ਤਾਂ ਹੈਗਾ ਹੀ ਆ ਫਿਰ ਉਹਦੇ ਆਸ ਪਾਸ ਹੋਰ ਕੀ ਹੋ ਰਿਹਾ ਕਿ ਲੋਕ ਨਾ ਰਹਿਣ ਰਹਿਣ ਵਾਸਤੇ ਆਪਣੇ ਘਰਾਂ ਨੂੰ ਇਸ ਤਰ੍ਹਾਂ ਕਰ ਰਹੇ ਆ ਕਿ ਰਿਹਾਇਸ਼ ਬਣਾ ਦਿੰਦੇ ਜਿੱਦਾਂ ਟੂਰਿਸਟ ਨੇ ਆ ਕੇ ਉਹਨਾਂ ਰੂਮਸ ਵਗੈਰਾ ਨਾਈਟ ਸਟੇਅ ਵਾਸਤੇ ਚਾਹੀਦੇ ਹੁੰਦੇ ਆ ਉਹ ਆਪਣੇ ਘਰ ਉਸੇ ਤਰ੍ਹਾਂ ਬਣਾ ਲੈਂਦੇ ਆ ਕਿ ਟੂਰਿਸਟ ਨੂੰ ਰੱਖਦੇ ਆ ਫਿਰ ਉਹਨਾਂ ਦੇ ਖਾਣੇ ਦਾ ਵੀ ਬ੍ਰੇਕਫਾਸਟ ਹੈ ਜਾਂ ਲੰਚ ਆ ਜੋ ਵੀ ਉਹਨਾਂ ਨੂੰ ਦੇਣਾ ਉਹਦਾ ਵੀ ਇੰਤਜ਼ਾਮ ਕਰਕੇ ਰੱਖਦੇ ਆ ਅਤੇ ਉਹਦੇ ਵਿੱਚ ਇਹ ਹੁੰਦਾ ਕਿ ਜਿਸ ਤਰ੍ਹਾਂ ਲੋਕਾਂ ਨੂੰ ਮਤਲਬ ਕਿ ਇੰ ਚੰਗੀ ਇਨਕਮ ਹੋ ਜਾਂਦੀ ਹੈ ਅਤੇ ਉ ਉਹਨਾਂ ਦਾ ਅੱਛਾ ਕੈਰ ਕਰੀਅਰ ਬਣ ਜਾਂਦਾ ਕਿਉਂਕਿ ਉੱਥੇ ਕੋਈ ਪੈਸਾ ਕੋਲ ਹੋਏਗਾ ਅਤੇ ਅੱਜ ਕੱਲ੍ਹ ਪੈਸੇ ਦੀ ਇੰਨੀ ਜ਼ਿਆਦਾ ਇੰਪੋਟੈਂਸ ਹੈ ਕਿ ਕੋਈ ਵੀ ਕੰਮ ਬਿਨਾਂ ਪੈਸੇ ਤੋਂ ਹੁੰਦਾ ਹੀ ਨਹੀਂ ਪੈਸਾ ਕੋਲ ਹੋਏਗਾ ਤਾਂ ਕੁਛ ਵੀ ਬੰਦਾ ਖਰੀਦ ਸਕਦਾ ਬਿਲਕੁਲ ਟੈਂਸ਼ਨ ਫਰੀ ਹੋ ਹੋ ਜਾਂਦਾ ਘਰ ਵਿੱਚ ਅੱਜ ਕੱਲ੍ਹ ਜਿਹੜੀਆਂ ਲੜਾਈਆਂ ਝਗੜੇ ਵੀ ਮੇਨ ਆਹੀਓ ਕਿ ਪੈਸੇ ਕਰਕੇ ਹੁੰਦੀਆਂ ਜਿਸ ਘਰ 'ਚ ਪੈਸੇ ਦੀ ਕਮੀ ਆ ਉੱਥੇ ਟੈਂਸ਼ਨਾਂ ਬਣੀਆਂ ਹੀ ਰਹਿੰਦੀਆਂ ਅਤੇ ਹੋਰ ਬਾਕੀ ਆਸ ਪਾਸ ਲੋਕ ਇੱਥੇ ਖੇਤੀਬਾੜੀ ਵੀ ਕਰਦੇ ਆ ਅੰਮ੍ਰਿਤਸਰ ਦੇ ਆਸ ਪਾਸ ਜਿਹੜੇ ਆ ਖੇਤੀ ਦਾ ਵੀ ਕੰਮ ਉੱਥੇ ਵੀ ਲੋਕ ਆਪਣਾ ਕਰੀਅਰ ਬਣਾਉਂਦੇ ਆ